ਵੈਸੇ ਤਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਤੋਂ ਜ਼ਿਆਦਾ ਅਗਰ ਗੱਲ ਕੀਤੀ ਜਾਵੇ ਬਹੁਤ ਹੀ ਸੁਤੰਤਰ ਸੈਨਾਨੀ ਹੋਏ ਹਨ ਜਿਨ੍ਹਾਂ ਨੇ ਆਪਣੇ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਯੋਗਦਾਨ ਭਰਪੂਰ ਕੀਤਾ ਹੈ ਪੰਜਾਬ ਦੀ ਗੱਲ ਕਰਾਂਗੇ ਤਾਂ ਆਪਾਂ ਪੰਜਾਬ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ਹੀਦਾਂ ਦੀ ਧਰਤੀ ਹੈ ਇੰਡੀਆ ਦੇ ਵਿੱਚ ਉਹ ਸੂਰਮੇ ਪੈਦਾ ਹੋਏ ਹਨ ਜੋ ਅੱਜ ਤੱਕ ਦੁਨੀਆਂ ਦੀ ਕਿਸੇ ਵੀ ਧਰਤੀ 'ਤੇ ਪੈਦਾ ਨਹੀਂ ਹੋਏ ਹਨ ਅਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਭਗਤ ਸਿੰਘ ਜੀ ਬਾਰੇ ਸ਼ਹੀਦ ਭਗਤ ਸਿੰਘ ਦਾ ਬਚਪਨ ਹੀ ਇੰਨਾ ਕਠਿਨਾਈਆਂ ਦੇ ਨਾਲ ਬੀਤਿਆ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਹੀ ਜਲ੍ਹਿਆਂਵਾਲਾ ਬਾਗ ਦਾ ਕਤਲ ਕਾਂਡ ਦੇਖ ਲਿਆ ਸੀ ਜਿਸ ਵਿੱਚ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਖੂਹ ਦੇ ਵਿੱਚ ਸ ਆਪਣੇ ਪੰਜਾਬੀ ਆਪਣੇ ਇੰਡੀਆ ਦੇ ਲੋਕ ਛਾਲ ਮਾਰ ਰਹੇ ਸਨ ਤਾਂ ਉਹ ਉਹਨਾਂ ਨੇ ਆਪਣੇ ਅੱਖੀ ਦੇਖਿਆ ਹੈ ਅਤੇ ਜਿਸ ਅੱਖੀਂ ਦੇਖਿਆ ਹੈ ਅਤੇ ਉਹ ਤੋਂ ਬਾਅਦ ਉਹਨਾਂ ਦੇ ਇੱਕ ਲਹਿਰ ਜਾਗੀ ਦਿਲ ਦੇ ਵਿੱਚ ਬਚਪਨ ਦੇ ਵਿੱਚ ਕਿ ਮੈਂ ਆਪਣੇ ਭਾਰਤ ਵਾਸੀਆਂ ਲਈ ਕੁਝ ਕਰਨਾ ਹੈ ਅੱਗੇ ਜਾ ਕੇ ਅਤੇ ਬਾਕੀ ਤੁਸੀਂ ਸਭ ਜਾਣਦੇ ਹੋ ਉਹਨਾਂ ਨੇ ਆਪਣੇ ਦੇਸ਼ ਦੇ ਲਈ ਕੀ ਕੀ ਕੀਤਾ ਹੈ ਕਿੱਥੇ ਕਿੱਥੇ ਉਹਨਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅਤੇ ਆਪਾਂ ਦੂਜੀ ਗੱਲ ਕਰਾਂਗੇ ਬਾਘਾ ਜਤਿੰਨ ਦੇ ਬਾਰੇ ਬਾਘਾ ਜਤਿੰਨ ਜੀ ਉੱਦਾਂ ਤਾਂ ਵੈਸੇ ਗੁਜਰਾਤ ਦੇ ਰਹਿਣ ਵਾਲੇ ਸਨ ਅਤੇ ਉਹਨਾਂ ਦਾ ਬਚਪਨ ਵੀ ਬਹੁਤ ਕਠਿਨਾਈਆਂ ਦੇ ਨਾਲ ਬੀਤਿਆ ਸੀ ਅਤੇ ਉਹ ਬਚਪਨ ਤੋਂ ਹੀ ਦੇ ਇੱਕ ਦੇ ਸੱਚੇ ਦੇਸ਼ ਭਗਤ ਰਹੇ ਹਨ ਉਹ ਗੁਜਰਾਤ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਐਕਸੀਡੈਂਟ ਵਿੱਚ ਖਤਮ ਹੋ ਗਏ ਸਨ ਉਹਨਾਂ ਦੀ ਮੌਤ ਹੋ ਗਈ ਸੀ ਅਤੇ ਉ ਉਹਨਾਂ ਦੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਬੜੀ ਸਿਸਟਰ ਨੇ ਪਾਲਿਆ ਹੋਇਆ ਸੀ ਬੜੀ ਭੈਣ ਨੇ ਅਤੇ ਆਉਣ ਵਾਲੇ ਟਾਈਮ ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿੱਦਾਂ ਦਾ ਹੋਏਗਾ ਕਿੱਦਾਂ ਦਾ ਨਹੀਂ ਹੋਏਗਾ ਜਿਵੇਂ ਜਿਵੇਂ ਉਹ ਬੜੇ ਹੁੰਦੇ ਗਏ ਜਾਣੀ ਕਿ ਜੁਆਨ ਹੁੰਦੇ ਗਏ ਉਹਨਾਂ ਦਾ ਆ ਉਹਨਾਂ ਦਾ ਆਉਣ ਵਾਲਾ ਟਾਈਮ ਉਹਨਾਂ ਹਾਰਡ ਹੁੰਦਾ ਗਿਆ ਅਤੇ ਉਨ੍ਹਾਂ ਨੇ ਆਪਣੇ ਪੰਦਰ੍ਹਾਂ ਸਾਲ ਦੀ ਉਮਰ ਦੇ ਵਿੱਚ ਇੱਕ ਬਾਘ ਦਾ ਸ਼ਿਕਾਰ ਕੀਤਾ ਸੀ ਉਹਨਾਂ ਨੇ ਜੰਗਲ ਦੇ ਵਿੱਚ ਉਹ ਆਪਣੇ ਮਾਮਾ ਜੀ ਦੇ ਨਾਲ ਗਏ ਹੋਏ ਸਨ ਜਿੱਥੇ ਉਹਨਾਂ ਨੇ ਇੱਕ ਬਾਘ ਦਾ ਸ਼ਿਕਾਰ ਕੀਤਾ ਅਤੇ ਬਾਘ ਨੂੰ ਮੌਤ ਦੇ ਉਤਾ ਘਾਟ ਉਤਾਰ ਦਿੱਤਾ ਬਾਘ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਕਿਉਂਕਿ ਉਸ ਬਾਘ ਨੇ ਜਿੱਥੇ ਉਹਨਾਂ ਦਾ ਪਿੰਡ ਸੀ ਉੱਥੇ ਦੇ ਕਈ ਲੋਕਾਂ ਨੂੰ ਜਖਮੀ ਅਤੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਹਨਾਂ ਦਾ ਅੱਗੇ ਟਾਇਮ ਬੀਤਿਆ ਉਹਨਾਂ ਨੇ ਫਿਰ ਅੱਗੇ ਆਪਣਾ ਜਦੋਂ ਮੈਰਿਜ ਹੋਈ ਫਿਰ ਉਹਨਾਂ ਨੂੰ ਅੰਗਰੇਜ਼ਾਂ ਦੇ ਟਾਇਮ ਗੋਰਿਆਂ ਦੇ ਟਾਇਮ ਦੇ ਵਿੱਚ ਉਹਨਾਂ ਨੂੰ ਬ੍ਰਿਟਿਸ਼ਟ ਸ਼ਾਸਨ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਫਾਈਨੈਂਸ਼ੀਅਲ ਮਨਿਸਟਰ ਦੀ ਜੋਬ ਮਿਲੀ ਅਤੇ ਉਹਨਾਂ ਨੇ ਮਨਿਸਟਰ ਦੇ ਤੌਰ 'ਤੇ ਉਹਨਾਂ ਨੇ ਸੰਨ ਉੱਨੀ ਸੌ ਪੱਚੀ ਦੇ ਵਿੱਚ ਉਹਨਾਂ ਨੇ ਆਪਣਾ ਜੋਬ ਕੀਤੀ ਉੱਥੇ ਅਤੇ ਉਹ ਜੋਬ ਅੰਗਰੇਜ਼ਾਂ ਦੇ ਗੋਰਿਆਂ ਦੇ ਕਹਿਣ ਮੁਤਾਬਿਕ ਹੀ ਕਰ ਰਹੇ ਸਨ ਲੇਕਿਨ ਉਹਨਾਂ ਦੇ ਦਿਲ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਬਹੁਤ ਸੀ ਜਾਣੀ ਕਿ ਅਗਰ ਆਪਾਂ ਗੱਲ ਕਰੀਏ ਕਿ ਅਗਰ ਕੋਈ ਵੀ ਫਾਈਨੈਸ਼ੀਅਲ ਲੋੜ ਪੈਂਦੀ ਤਾਂ ਉਹ ਆਪਣੇ ਦੇਸ਼ ਭਗਤਾਂ ਦੇ ਨਾਲ ਵੀ ਬਹੁਤ ਖੜ੍ਹਦੇ ਹੋ ਸਨ ਅਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਬੜਾ ਤਕੜਾ ਭੂਚਾਲ ਆਉਣ ਜਾ ਰਿਹਾ ਹੈ ਇੱਕ ਸਾਈਡ ਤਾਂ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਜ਼ਾਦੀ ਦੀ ਲੜਾਈ ਲੜ ਰਹੇ ਸਨ ਅਤੇ ਦੂਜੀ ਸਾਈਡ ਉਹਨਾਂ ਦਾ ਬੇਟਾ ਜੋ ਕਿ ਕੈਂਸਰ ਦੇ ਨਾਲ ਪੀੜਿਤ ਸੀ ਅਤੇ ਉਸ ਟਾਈਮ ਕਿਸੇ ਨੂੰ ਨਹੀਂ ਪਤਾ ਸੀ ਕਿ ਹਾਂ ਜੀ ਕੈਂਸਰ ਕਿਆ ਚੀਜ਼ ਹੁੰਦੀ ਹੈ ਕਿਆ ਚੀਜ਼ ਨਹੀਂ ਹੁੰਦੀ ਹੈ ਅਤੇ ਉਨ੍ਹਾਂ ਨੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਆਪਣੀ ਪਤਨੀ ਨੂੰ ਆਪਣੀ ਸਿਸਟਰ ਨੂੰ ਉਹਨਾਂ ਦੇ ਗਾਉਂ ਭੇਜ ਦਿੱਤਾ ਉਹ ਆਪ ਸ਼ਹਿਰ ਵਿੱਚ ਰਹਿ ਰਹੇ ਸਨ ਅਤੇ ਉੱਥੇ ਜਦੋਂ ਉਹ ਆਪਣਾ ਉਹਨਾਂ ਨੇ ਇਕੱਲਿਆਂ ਨੇ ਫਿਰ ਆਜ਼ਾਦੀ ਦੀ ਲੜਾਈ ਨੂੰ ਯੋਗਦਾਨ ਉਹਨਾਂ ਨੇ ਪੂਰਾ ਰੱਖਿਆ ਆਜ਼ਾਦੀ ਲੜਾਈ ਵੱਲ ਧਿਆਨ ਦਿੱਤਾ ਇੱਕ ਸਾਇਡ ਇੱਕ ਟਾਈਮ ਉਹਨਾਂ 'ਤੇ ਇੱਦਾਂ ਦਾ ਵੀ ਆਇਆ ਜਿੱਥੇ ਉਹਨਾਂ ਨੂੰ ਇੱਕ ਸਾਇਡ ਆਪਣੇ ਬੇਟੇ ਨੂੰ ਚੁਣਨਾ ਸੀ ਇੱਕ ਸਾਇਡ ਹਜ਼ਾਰ ਬੰਦਿਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਚੁਣਨਾ ਸੀ ਉਹਨਾਂ ਨੇ ਆਪਣੇ ਆ ਬੇਟੇ ਨੂੰ ਛੱਡ ਕੇ ਹਜ਼ਾਰ ਦੇ ਦੇਸ਼ ਵਾਸੀਆਂ ਨੂੰ ਚੁਣਨਾ ਬੇਹਤਰ ਸਮਝਿਆ ਉਹਨਾਂ ਨੇ ਆਪਣੇ ਹਜ਼ਾਰ ਦੇਸ਼ ਵਾਸੀਆਂ ਦੀ ਜਾਨ ਬਚਾਈ ਪੂਰੇ ਦੇ ਗਾਉਂ ਦੀ ਪੂਰੇ ਪਿੰਡ ਦੀ ਜਾਨ ਬਚਾਈ ਅਤੇ ਬਾਅਦ ਦੇ ਵਿੱਚ ਐਂਡ ਦੇ ਵਿੱਚ ਉਹ ਕਰਨਾਟਕਾ ਦੇ ਜੰਗਲ ਦੇ ਵਿੱਚ ਜਦੋਂ ਅ ਦੇਸ਼ ਦੀ ਆਜ਼ਾਦੀ ਲੜਦੇ ਲੜਦੇ ਉਹ ਸ਼ਹੀਦ ਹੋ ਗਏ ਆਪਣਾ ਗੱਲ ਕਰੀਏ ਆਪਣੇ ਭਾਰਤ ਦੀ ਆਪਣੇ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਇਤਿਹਾਸਿਕ ਮਨੋਰੰਜਨ ਦੇ ਹ ਹੋਏ ਹਨ ਬਾਕੀ ਬਹੁਤ ਹੀ ਸ਼ਹੀਦਾਂ ਦੀ ਧਰਤੀ ਹੈ ਧੰਨਵਾਦ